ਅਸੀਂ ਇੱਕ ਉਬਰ ਕੀਤੀ ਮੇਰਾ ਸਕੂਲ ਵਿੱਚ ਪੇਪਰ ਸੀ ਡਰੈਵਰ ਨੇ ਸਾਨੂੰ ਇੱਕ ਘੰਟੇ ਤੱਕ ਪਹੁੰਚਾ ਦਿੱਤਾ ਉਸ ਡਰੈਵਰ ਦੀ ਆਦਤ ਬਹੁਤ ਹੀ ਅੱਛੀ ਸੀ ਡਰੈਵਰ ਦਾ ਨਾਮ ਗੁਰਪ੍ਰੀਤ ਸੀ ਉਸ ਦੀ ਆਦਤ ਬਹੁਤ ਹੀ ਵਧੀਆ ਸੀ ਉਸ ਵਿੱਚ ਉਸ ਨਾਲ ਇੱਕ ਘੰਟਾ ਬਿਤਾਇਆ ਸਾਨੂੰ ਬਾਹਰ ਦਾ ਬੰਦਾ ਨਹੀਂ ਲੱਗਿਆ ਕੋਈ ਸਾਡੇ ਘਰ ਦਾ ਹੀ ਮੈਂਬਰ ਲੱਗਿਆ ਉਸ ਦਾ ਸੁਭਾਅ ਬਹੁਤ ਹੀ ਸੋਹਣਾ ਹੈ ਅਤੇ ਉਹ ਸਾਨੂੰ ਸਾਰੀਆਂ ਸਹੇਲੀਆਂ ਨੂੰ ਵਧੀਆ ਲੱਗਿਆ ਸਾਨੂੰ ਪੰਜ ਮਿੰਟਾਂ ਤੱਕ ਹੀ ਪਹੁੰਚਾ ਦਿੱਤਾ ਉਸਨੇ ਉਸ ਦੀ ਆਦਿ